ਨੈੱਟ ਦਾ ਸਿਸਟਮ ਵਧੀਆ ਹੈ ਇਹ ਆਪਾਂ ਕੋਈ ਵੀ ਬੋਲ ਕੇ ਚੀਜ਼ ਆਪਾਂ ਲਿਖ ਕੇ ਕਿਸੇ ਨੂੰ ਭੇਜ ਸਕਦੇ ਹਾਂ ਬੈਠੇ ਬੈਠੇ ਕਿਸੇ ਵੀ ਕੰਟਰੀ 'ਚ ਆਪਾਂ ਦੇਖ ਸਕਦੇ ਹਾਂ ਜੋ ਵੀ ਉਹ ਕਰੰਟੀ ਦਾ ਆਪਾਂ ਕੋਈ ਚੀਜ਼ ਜਿਹੜੀਆਂ ਇੱਦਾਂ ਦੀਆਂ ਨਹੀਂ ਆਪਾਂ ਨੂੰ ਪਤਾ ਉਹ ਇੰਟਰਨੈਟ 'ਤੇ ਆਪਾਂ ਚੀਜ਼ਾਂ ਦੇਖ ਸਕਦੇ ਹਾਂ ਜੋ ਕਿ ਬਹੁਤ ਹੀ ਵਧੀਆ ਹੈਗਾ ਅਤੇ ਅੱਜ ਕੱਲ੍ਹ ਦੇ ਮਤਲਬ ਮਾਹੌਲ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਇੰਟਰਨੈਟ ਹੋਣੀਆਂ ਜ਼ਰੂਰੀ ਆ ਇੰਟਰਨੈਟ ਨੇ ਬਹੁਤ ਜਿਹੜਾ ਹੈ ਜ ਜ਼ਮਾਨੇ ਨੂੰ ਹੈਗਾ ਨਾ ਜਿਹੜਾ ਬਹੁਤ ਬਹੁਤ ਰਫਤਾਰ ਦਿੱਤੀ ਆ ਇੰਟਰਨੈਟ ਦੇ ਜ਼ਰੀਏ ਅੱਜ ਆਪਾਂ ਲੋਕਾਂ ਦਾ ਕਾਰੋਬਾਰ ਚੱਲ ਰਿਹਾ ਔਰ ਵਧੀਆ ਹੈਗਾ ਇੱਦਾਂ ਦੀਆਂ ਚੀਜ਼ਾਂ ਇੰਟਰਨੈਟ ਹੋਣੀਆਂ ਚਾਹੀਦੀਆਂ ਸੀ ਪਹਿਲਾਂ ਇੰਟਰਨੈਟ ਨਹੀਂ ਸੀ ਚਿੱਠੀਆਂ ਨੇ ਲਿਖਦੇ ਸੀ ਉਹ ਚਿੱਠੀਆਂ ਮਹੀਨਾ ਮਹੀਨਾ ਪਹੁੰਚਦੀਆਂ ਨਹੀਂ ਸੀ ਲੋਕਾਂ ਦੇ ਪ੍ਰੋਗਰਾਮ ਲੰਘ ਜਾਂਦੇ ਸੀਗੇ ਇਸ ਕਰਕੇ ਇੰਟਰਨੈਟ ਦਾ ਜ਼ਮਾਨਾ ਬਹੁਤ ਡਿਜੀਟਲ ਜ਼ਮਾਨਾ ਹੈਗਾ ਔਰ ਵਧੀਆ ਬਹੁਤ ਵਧੀਆ ਹੈਗਾ ਇਹਦੇ ਸਹਾਰੇ ਆਪਾਂ ਜੋ ਮਰਜ਼ੀ ਦੇਖ ਸਕਦੇ ਹਾਂ ਬੋਲ ਸਕਦੇ ਹਾਂ ਸਮਝਾ ਸਕਦੇ ਹਾਂ ਚਿੱਠੀ ਨਹੀਂ ਪਾਉਂਦੇ ਨਾ ਕੋਈ ਹੋਰ ਨਹੀਂ ਲਿਖ ਕੇ ਆਪਾਂ ਕਿਸੇ ਨੂੰ ਵਟਸਐਪ ਕਰ ਸਕਦੇ ਹਾਂ ਅਤੇ ਔਰ ਵਧੀਆ ਇੰਟਰਨੈਟ ਦਾ ਜ਼ਮਾਨਾ ਹੈਗਾ ਇਹ ਬਹੁਤ ਵਧੀਆ ਬਹੁਤ ਵਧੀਆ ਹੋਇਆ ਜਿਹੜਾ ਮਤਲਬ ਇੰਟਰਨੈਟ ਦਾ ਜ਼ਮਾਨਾ ਆ ਗਿਆ ਪਹਿਲਾਂ ਮਾਹੌਲ ਕੋਈ ਜਾਣਦਾ ਨਹੀਂ ਸੀ